ਵੈਸੇ ਤਾਂ ਮੈਨੂੰ ਪੰਜਾਬ ਦੇ ਵਿੱਚ ਮਨੋਰੰਜਨ ਉਦਯੋਗ ਦੀ ਚੁਣੌਤੀਆਂ ਬਾਰੇ ਕੁਛ ਖਾਸ ਤਾਂ ਪਤਾ ਨਹੀਂ ਪਰ ਮੈਂ ਕੁਛ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੀ ਹਾਂ ਜਿਵੇਂ ਕਿ ਅਸੀਂ ਕੋਈ ਵੀ ਨਿਊ ਮੂਵੀਜ਼ ਵਗੈਰਾ ਜੇ ਥਿਏਟਰ 'ਚ ਲੱਗਦੀ ਆ ਅਤੇ ਉਹ ਅਸੀਂ ਪੈਸੇ ਖਰਚ ਕੇ ਥਿਏਟਰ ਦੇ ਵਿੱਚ ਜਾ ਕੇ ਉਹਨੂੰ ਅਸੀਂ ਸਿਨਮੇ ਘਰ ਦੇ ਵਿੱਚ ਜਾ ਕੇ ਦੇਖਦੇ ਹਾਂ ਪਰ ਕੁਝ ਅਜਿਹੇ ਹੁੰਦੇ ਆ ਜੋ ਕਿ ਪ੍ਰੋਕਸੀ ਵਗੈਰਾ ਜਾਂ ਉਹਨੂੰ ਯੂਜ ਕਰਕੇ ਉਹ ਕੋਪੀ ਬਣਾ ਕੇ ਇੰਟਰਨੈਟ ਸਾਈਟ 'ਤੇ ਪਾ ਜਾਂਦੇ ਹਨ ਉਸਦੇ ਨਾਲ ਸਾਡੀ ਸੋਸ਼ਲ ਮੀਡੀਆ ਵਾਲਿਆਂ ਨੂੰ ਔਰ ਸਾਡੀ ਫਿਲਮ ਇੰਡਸਟਰੀ ਨੂੰ ਇਹ ਮ ਸਭ ਤੋਂ ਵੱਧ ਅਤੇ ਜਿਹੜਾ ਮਹਾਨੀ ਹੁੰਦੀ ਏ ਇਹ ਹੁੰਦੀ ਹੈ ਕਿ ਜੋ ਪੈਸੇ ਖਰਤ ਖਰਚ ਕੇ ਜਿਹੜੇ ਲੋਕ ਉੱਥੇ ਦੇਖਣ ਜਾਂਦੇ ਹਨ ਔਰ ਕੁਛ ਲੋਕਾਂ ਨੂੰ ਉਹ ਫਰੀ ਦੇ ਵਿੱਚ ਹੀ ਉਹ ਦੇਖਣ ਦਾ ਮੌਕਾ ਮਿਲ ਜਾਂਦਾ ਇਹਦੇ ਵਿੱਚ ਫਾਈਨੈਂਸ਼ੀਅਲ ਤੌਰ 'ਤੇ ਸਾਡੀ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਨੁਕਸਾਨ ਪੈਂਦਾ ਹੈ ਔਰ ਜੇ ਗੱਲ ਕਰੀਏ ਅਸੀਂ ਕੋਪੀਰਾਈਟਸ ਦੇ ਕਾਰਨ ਜਿਸ ਤਰ੍ਹਾਂ ਅੱਜ ਕੱਲ੍ਹ ਬਹੁਤ ਚਲਿਆ ਹੈ ਕਿ ਅਸੀਂ ਕਿਸੇ ਗਾਣੇ ਦੀ ਕੋਪੀ ਕਰਕੇ ਉਸਨੂੰ ਉਹਦੇ ਐਡਟਿੰਗ ਵਗੈਰਾ ਕਰ ਲੈਂਦੇ ਹਨ ਜਿਹਨਾਂ ਦਾ ਨੁਕਸਾਨ ਸਭ ਤੋਂ ਵੱਧ ਇਹ ਹੁੰਦਾ ਆ ਕਿ ਉਹ ਉਹਨੂੰ ਕੋਈ ਵੀ ਮਿਸਯੂਜ ਕਰ ਸਕਦਾ ਏ ਲਾਈਕ ਅਸੀਂ ਕਰੀਏ ਕਿ ਏ ਉਹ ਹਰੇਕ ਇੱਕ ਗਾਣੇ ਦੀ ਆਪਣੀ ਇੱਕ ਇੱਕ ਪਹਿਚਾਣ ਦੇ ਅਕੋਡਿੰਗ ਉਹਦੀ ਇੱਕ ਆਪਣੀ ਕੋਪੀਰਾਈਟਸ ਹੁੰਦੀ ਆ ਨਾ ਅਤੇ ਇਹ ਜਿਹੜੀਆਂ ਜ ਕਰਦੇ ਆ ਉਹਦੇ ਨਾਲ ਕਾਫੀ ਇਹਨਾਂ ਨੂੰ ਪੰਜਾਬ ਆਪਣੇ ਉਦਯੋਗ ਖੇਤਰ ਨੂੰ ਬਹੁਤ ਨੁਕਸਾਨ ਪਹੁੰਚਿਆ ਜਾਂਦਾ ਹੈ ਸੋਸਾਈ ਸਕਿਉਰਟੀ ਔਰ ਪਰਸਨਲ ਪ ਪ੍ਰਾਈਵੇਸੀ ਦੇ ਅਕੋਡਿੰਗ ਕਰੀਏ ਕਿ ਇਹਨਾਂ ਦੀ ਜਿਹੜੀਆਂ ਚੁਣਨ ਹੁੰਦੀਆਂ ਹੈਗੀਆਂ ਆਪਣੀਆਂ ਜੋ ਵੀ ਸਕਿਉਰਟੀ ਰੱਖਦੇ ਆ ਉਹ ਇਹਨਾਂ 'ਚ ਕੋਪੀਰਾਈਟਸ ਕਰਕੇ ਔਰ ਸੋਸ਼ਲ ਮੀਡੀਆ ਦੇ ਵਿੱਚ ਉਹ ਪਾਉਣ ਕਰਕੇ ਉਹ ਸ ਪ੍ਰਾਈਵੇਸੀ ਉਹਨਾਂ ਦੀ ਖਤਮ ਹੋ ਜਾਂਦੀ ਆ